ਮੈਂ ਆਪਣੇ ਜਾਨਵਰਾਂ ਦੀ ਦੇਖਭਾਲ ਆਪ ਹੀ ਕਰਦਾ ਪਰ ਥੋੜ੍ਹੀ ਹੈਲਪ ਵਾਸਤੇ ਮੈਂ ਨਾਲ ਕਾਮੇ ਵੀ ਰੱਖੇ ਹੋਏ ਹਨ ਮੇਰੇ ਕੋਲ ਕਰੀਬ ਵੀਹ ਮੱਝਾਂ ਹਨ ਅਤੇ ਇਸ ਨਾਲ ਇਹਨਾਂ ਨੂੰ ਸਾਂਭ ਸੰਭਾਲ ਕਰਨ ਵਾਸਤੇ ਮੈਂ ਏਜ ਗਰੁੱਪ ਦੇ ਵਾਈਜ ਜਿਹੜਾ ਆਪਣਾ ਸ਼ੈੱਡ ਹੈ ਉਹਦੇ ਵਿੱਚ ਖਾਨੇ ਵੰਡੇ ਹੋਏ ਹਨ ਅਤੇ ਮੇਰੇ ਕੋਲ ਕੁਝ ਗਾਵਾਂ ਵੀ ਹਨ ਜਿਹਦੇ ਵਿੱਚ ਛੋਟੇ ਬੱਚੇ ਅਲੱਗ ਹਨ ਅਤੇ ਥੋੜ੍ਹੇ ਜਿਹੇ ਜਿਹੜੇ ਹੀਫਰ ਹੈਗੀਆਂ ਨੇ ਜਾਂ ਜਿਹੜੀਆਂ ਝੋਟੀਆਂ ਨੇ ਉਹਨਾਂ ਨੂੰ ਅਸੀਂ ਅਲੱਗ ਰੱਖਦੇ ਹਾਂ ਅਤੇ ਦੁੱਧ ਦੇਣ ਵਾਲੇ ਪਸ਼ੂਆਂ ਨੂੰ ਅਲੱਗ ਰੱਖਦੇ ਹਾਂ ਇਹਦੇ ਵਿੱਚ ਅਸੀਂ ਜਿਹੜੇ ਪ੍ਰੈਗਨੈਂਟ ਐਨੀਮਲਜ ਨੇ ਉਹਨਾਂ ਦਾ ਵੀ ਖਾਸ ਖਿਆਲ ਕਰਦੇ ਕਿ ਉਹਨਾਂ ਨੂੰ ਬਾਕੀ ਦੂਸਰੇ ਜਾਨਵਰਾਂ ਨਾਲੋਂ ਅਲੱਗ ਰੱਖੀਏ ਤਾਂ ਕਿ ਕੋਈ ਨੁਕਸਾਨ ਨਾ ਹੋ ਸਕੇ ਹਾਈਜੀਨ ਇਸ ਤਰੀਕੇ ਨਾਲ ਹੀ ਮੇਨਟੇਨ ਹੋ ਜਾਂਦੀ ਕਿ ਜਦੋਂ ਤੁਸੀਂ ਅਲੱਗ ਅਲੱਗ ਪਸ਼ੂਆਂ ਨੂੰ ਅਲੱਗ ਅਲੱਗ ਤਰੀਕੇ ਦੇ ਨਾਲ ਰੱਖੋਗੇ ਉਹਨਾਂ ਨੂੰ ਏਜ ਗਰੁੱਪ ਵਾਈਜ ਫੇਰ ਅਸੀਂ ਫੀਡ ਦਿੰਦੇ ਹਾਂ ਕਿ ਜਿਹਦੀ ਰਿਕੁਆਇਰਮੈਂਟ ਜਿੰਨੀ ਹੈ ਉਸ ਹਿਸਾਬ ਦੇ ਨਾਲ ਫੀਡ ਦਿੱਤੀ ਜਾਂਦੀ ਹੈ ਅਤੇ ਇਸ ਤਰੀਕੇ ਨਾਲ ਅਸੀਂ ਇਹਨਾਂ ਨੂੰ ਐਨੀਮਲਜ ਨੂੰ ਅਲੱਗ ਅਲੱਗ ਪੈਨ ਬਣਾਏ ਹੋਏ ਨੇ ਇੱਕ ਸ਼ੈੱਡ ਦੇ ਵਿੱਚ ਅਤੇ ਉਹਦੇ ਵਿੱਚ ਹੀ ਅਸੀਂ ਇਹਨਾਂ ਨੂੰ ਦੇਖਭਾਲ ਕਰਦੇ ਹਾਂ